ਹਾਂਜੀ ਅਸੀਂ ਦੁਪਹਿਰ ਨੂੰ ਖਾਣਾ ਬਣਾਉਂਦੇ ਹਾਂ ਏ ਜਿੱਦਾਂ ਦਾਵਲ ਦਾਲ ਬਣਾ ਲਿੱਤੀ ਸਬਜ਼ੀ ਬਣਾ ਲਿੱਤੀ ਸੁੱਕੀ ਸਬਜ਼ੀ ਬਣਾ ਲਿੱਤੀ ਤਰੀ ਵਾਲੀ ਸਬਜ਼ੀ ਬਣਾ ਲਿੱਤੀ ਨਾਲ ਰਾਇਤਾ ਪਾ ਲਿੱਤਾ ਨਾਲ ਚਾਵਲ ਹੋ ਗਏ ਸਲਾਦ ਹੋ ਗਈ ਰੋਟੀ ਹੋ ਗਈ ਉਹਦੇ ਦਾ ਅਸੀਂ ਹੁਣ ਤਰੀ ਵਾਲੀ ਸਬਜ਼ੀ ਦਾ ਪਨੀਰ ਬਣਾਉਂਦੇ ਹਾਂ ਉਹਦੇ ਵਿੱਚ ਘਿਓ ਗਰਮ ਕੀਤਾ ਉਹਦੇ 'ਚ ਅਤੇ

ਸੁੱਕੀ ਸਬਜ਼ੀ ਵੀ ਬਣਾ ਲੈਂਦੇ ਹਾਂ ਜਿੱਦਾਂ ਅਰਬੀ ਹੋਈ ਭਿੰਡੀ ਹੋਈ ਗੋਭੀ ਹੋਈ ਗਾਜਰਾਂ ਮਟਰ ਹੋਈਆਂ ਇਹ ਵੀ ਸੁੱਕੀ ਸਬਜ਼ੀ ਵੀ ਬਣਾ ਲੈਂਦੇ ਹਾਂ ਰਾਇਤਾ ਬਣਾ ਲੈਂਦੇ ਹਾਂ ਰਾਇਤਾ ਜਿੱਦਾਂ ਵੀ ਭੱਲੇ ਦਾ ਹੋ ਗਿਆ ਪਕੌੜੀਆਂ ਦਾ ਹੋ ਗਿਆ ਜਿੱਦਾਂ ਖੀਰੇ ਟਮਾਟਰ ਦਾ ਘੀਏ ਦਾ ਘੀਏ ਨੂੰ ਕੱਦੂਕਸ ਕਰਕੇ ਉਹਦਾ ਵੀ ਰਾਇਤਾ ਬਣਦਾ ਉਹਦਾ ਵੀ ਬਣਾ ਲਈ ਦਾ ਵਾ ਬਸ ਐਦੀ ਰਾਇਤਾ ਵੀ ਬਣਾ ਲਈ ਦਾ ਸਲਾਦ ਵੀ ਕਰਨ ਲਈ ਦੀ ਚਾਵਲ ਹੀ ਬਣਾਈ ਦੇ ਬਣਾ ਲਈ ਦੇ ਆ ਅਤੇ ਰੋਟੀ ਇਹ ਦੁਪਹਿਰ ਦਾ ਖਾਣਾ ਹੁੰਦਾ ਆ

ਬਸ ਫਿਰ ਉਹ ਵੀ ਫਿਰ ਰਾਤ ਨੂੰ ਅਸੀਂ ਦਹੀਂ ਨਹੀਂ ਖਾਂਦੇ ਵੀ ਰਾਤ ਨੂੰ ਦਹੀਂ ਖਾਣੀ ਰਹਿੰਦੇ ਚੰਗੀ ਨਹੀਂ ਹੁੰਦੀ ਫਿਰ ਅਸੀਂ ਰਾਤੀ ਖਾਂਦੇ ਨਹੀਂ ਗੇ ਰਾਤ ਨੂੰ ਸਲਾਦ ਲੈਂਦੇ ਹਾਂ ਦਾਲ ਲੈਂਦੇ ਹਾਂ ਰੋਟੀ ਲੈਂਦੇ ਚਾਵਲ ਲੈ ਲੈਂਦੇ ਬਸ ਹਾਂਜੀ ਠੀਕ ਹੈ ਜੀ